ਹਾਂਜੀ ਇਹ ਤਾਂ ਅਕਸਰ ਦੇਖਿਆ ਗਿਆ ਹੈ ਜਦੋਂ ਅਸੀਂ ਉੱਚੀਆਂ ਚੜਾਈਆਂ ਚੜਦੇ ਹਾਂ ਤਾਂ ਸਾਡੀ ਆਕਸੀਜਨ ਦੀ ਕਮੀ ਮਹਿਸੂਸ ਹੋ ਜਾਂਦੀ ਹੈ ਹਾਂਜੀ ਅਤੇ ਜਦੋਂ ਅਸੀਂ ਹੇਮਕੁੰਟ ਸਾਹਿਬ ਗਏ ਸੀ ਜਦੋਂ ਅਸੀਂ ਚੜਾਈ ਚੜੀ ਤਾਂ ਅਸੀਂ ਇੱਕਦਮ ਬਿਲਕੁਲ ਠੀਕ ਸੀ ਤੇ ਜਦੋਂ ਅਸੀਂ ਵਾਪਸ ਨੂੰ ਆ ਰਹੇ ਸੀ ਤਾਂ ਉਦੋਂ ਮੈਨੂੰ ਮਤਲਬ ਕਿ ਆਕਸੀਜਨ ਦੀ ਕਮੀ ਮਹਿਸੂਸ ਹੋ ਰਹੀ ਸੀ ਤਾਂ ਉਸੇ ਟਾਈਮ ਮਤਲਬ ਕਿ ਉੱਥੇ ਮੈਡੀਕਲ ਸਹੂਲਤਾਂ ਆਮ ਮਤਲਬ ਮਿਲਦੀਆਂ ਹਨ ਅਤੇ ਥੋੜ੍ਹੇ ਥੋੜ੍ਹੇ ਰਸਤਿਆਂ 'ਤੇ ਡਾਕਟਰ ਦੀਆਂ ਦੁਕਾਨਾਂ ਹੁੰਦੀਆਂ ਹਨ ਤਾਂ ਮੇਰੇ ਘਰਦਿਆਂ ਨੇ ਮੈਨੂੰ ਜਦੇ ਡਾਕਟਰ ਜੀ ਕੋਲ ਲੈ ਕੇ ਗਏ ਅਤੇ ਡਾਕਟਰ ਜੀ ਨੇ ਮੇਰਾ ਬੀਪੀ ਚੈੱਕ ਕੀਤਾ ਮੇਰਾ ਬੀਪੀ ਬਹੁਤ ਡਾਊਨ ਸੀ ਤਾਂ ਮੈਨੂੰ ਉਹਨਾਂ ਨੇ ਓਆਰਐਸ ਦਾ ਘੋਲ ਪਿਲਾਇਆ ਜਿਸ ਨਾਲ ਮਤਲਬ ਕਿ ਮੈਨੂੰ ਥੋੜ੍ਹੀ ਜਿਹੀ ਰਾਹਤ ਮਹਿਸੂਸ ਹੋਈ ਅਤੇ ਮੈਂ ਮਤਲਬ ਕਿ ਥੋੜ੍ਹੇ ਹੀ ਸਮੇਂ ਦੇ ਵਿੱਚ ਮੈਂ ਠੀਕ ਹੋ ਗਈ ਸੀ ਅਤੇ ਇਹ ਇਹ ਇੱਕ ਆਮ ਗੱਲ ਹੈ ਕਿ ਚੜਾਈ ਚੜਦੇ ਹੋਏ ਆਕਸੀਜਨ ਦੀ ਕਮੀ ਉੱਥੇ ਮਹਿਸੂਸ ਜ਼ਰੂਰ ਹੁੰਦੀ ਹੈ